ਹੈਲੋ ਨਮਸਕਾਰ ਜੀ ਹਾਂਜੀ ਹਾਂਜੀ ਰਾਜਕੁਮਾਰ ਜੀ ਨੇ ਤੁਹਾਡਾ ਨੰਬਰ ਦਿੱਤਾ ਪੇਂਟਰ ਹੀ ਗੱਲ ਕਰ ਰਹੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਸਰ ਮੈਂ ਪੰਕਜ ਗੱਲ ਕਰ ਰਿਹਾ ਸੀਗਾ ਅਤੇ ਸਰ ਆਪਾਂ ਨੇ ਇੱਕ ਫਲੈਟ ਲਿੱਤਾ ਸੀਗਾ ਫ਼ਾਜ਼ਿਲਕਾ ਦੇ ਵਿੱਚ ਅਤੇ ਉਹ ਥੋੜ੍ਹਾ ਐਂਟੀਰੀਅਰ ਪੇਂਟ ਬਾਰੇ ਪੁੱਛਣਾ ਸੀਗਾ ਆਪਾਂ ਘਰ ਬਣਾ ਲਿਆ ਸੀਗਾ ਮਤਲਬ ਬਸ ਮਿਸਤਰੀ ਦੋ ਚਾਰ ਦਿਨਾਂ ਤੱਕ ਆਪਣਾ ਕੰਮ ਖਤਮ ਕਰ ਲੈਣਗੇ ਅਤੇ ਬਸ ਆਪਾਂ ਉਹ ਪੇਂਟ ਦਾ ਲਗਵਾਉਣਾ ਸੀਗਾ ਪਹਿਲਾਂ ਲਗਵਾਏ ਨੀਗੇ ਵੀ ਨਾ ਉਹ ਫਰਸ਼ ਟਾਈਲਾਂ ਵਗੈਰਾ ਥੋੜ੍ਹੀਆਂ ਮਹਿੰਗੀਆਂ ਸੀਗੀਆਂ ਉਹਦੇ ਕਰਕੇ ਫਿਰ ਬਈ ਚਲੋ ਨੁਕਸਾਨ ਨਾ ਹੋ ਜਾਵੇ ਜੋ ਟਾਈ ਹਾਂ ਹਾਂ ਉਹ ਟਾਈਲਾਂ ਫਿਰ ਅਸੀਂ ਬਾਅਦ 'ਚ ਹੀ ਲਗਵਾਵਾਂਗੇ ਪਹਿਲਾਂ ਅਸੀਂ ਪੇਂਟ ਕਰਵਾਉਣਾ ਹੈ ਬਈ ਅਸੀਂ ਦੋ ਕਮਰੇ ਆ ਸਾਡੇ ਦੋ ਕਮਰੇ ਹਨ ਥੱਲੜੇ ਤਿਆਰ ਕਰਵਾਉਣੇ ਆ ਇੱਕ 'ਚ ਤਾਂ ਪੀ ਓ ਪੀ ਕਰਵਾਉਣੀ ਹੈ ਜੀ ਅਤੇ ਇੱਕ 'ਚ ਆਪਾਂ ਡਾਊਨ ਸਿਲਿੰਗ ਕਰਵਾ ਕੇ ਅਤੇ ਸ਼ੀਟਾਂ ਲਗਵਾ ਦੇਣੀਆਂ ਹੁਣ ਤੁਸੀਂ ਦੱਸੋ ਕੀ ਹਿਸਾਬ ਕਿਤਾਬ ਹੈ ਤੁਹਾਡਾ ਸਕੇਅਰ ਫੁੱਟ ਦੇ ਹਿਸਾਬ ਨਾਲ ਕਿਵੇਂ ਲੈਂਦੇ ਹੋ ਜੀ ਚਾਰਜੇਸ ਹਾਂਜੀ ਹਾਂਜੀ ਬਹੁਤ ਬਹੁਤ ਤੁਹਾਨੂੰ ਵੀ ਜੀ ਮਕਾਨ ਦਾ ਬਾਈ ਆਪਣਾ ਪੰਦਰਾਂ ਬਾਏ ਸੱਠ ਹੈ ਅਤੇ ਕਮਰਾ ਆਪਣਾ ਮੰਨ ਕੇ ਚੱਲੋ ਤੁਸੀਂ ਕੋਈ ਅੱਠ ਬ ਦਸ ਬਾਏ ਬਾਰਾਂ ਦੋ ਦੋਨੋਂ ਕਮਰੇ ਆ ਸਕੇਅਰ ਸਾਈਜ਼ ਹੀ ਆ ਕਮਰਿਆਂ ਅਤੇ ਉਸ ਹਿਸਾਬ ਨਾਲ ਤੁਸੀਂ ਹਾਂ ਪ੍ਰੋਪਰ ਕਮਰਾ ਹੀ ਹੈਗਾ ਜਿਵੇਂ ਅਤੇ ਔਰ ਇੱਕ ਤਾਂ ਆਪਾਂ ਸ਼ੀਟਸ ਲਗਵਾਉਣੀ ਹੈ ਉੱਪਰ ਹਾਂਜੀ ਹਾਂਜੀ ਨਹੀਂ ਨਹੀਂ ਠੀਕ ਹੈ ਨਹੀਂ ਡਾਊਨ ਸੀਲਿੰਗ ਤਾਂ ਕਰਵਾਉਣੀ ਹੈ ਤੁਸੀਂ ਕਲਰ ਦੱਸੋ ਕਲਰ ਕਿਹੜਾ ਵਧੀਆ ਤੁਹਾਡੇ ਅਕੋਰਡਿੰਗ ਜਿਹੜਾ ਅੱਜ ਦੇ ਟਰੈਂਡ ਦੇ ਵਿੱਚ ਚੱਲ ਰਿਹਾ ਵੀ ਹਾਂ ਯਾਰ ਇਹ ਕਲਰ ਵਧੀਆ ਟਰੈਂਡ 'ਚ ਚੱਲ ਰਿਹਾ ਮੈਨੂੰ ਦੱਸ ਦਿਓ ਹਾਂ ਇੱਕ ਡਾਊਨ ਸਿਲਿੰਗ ਦਾ ਵੀ ਦੱਸ ਦਿਓ ਡਾਊਨ ਸਿਲਿੰਗ ਦਾ ਤੁਸੀਂ ਮੈਨੂੰ ਡਿਜ਼ਾਇਨ ਦਿਖਾ ਦੋਂਗੇ ਫੋਨ 'ਤੇ ਤਾਂ ਚਲੋ ਆਪਾਂ ਫੋਨ 'ਤੇ ਮਾੜਾ ਮੋਟਾ ਵੇਖ ਲਾਂਗੇ ਬਟ ਮੇਨ ਤੁਸੀਂ ਮੈਨੂੰ ਉਹ ਦਿਖਾ ਦਿਓ

ਠੀਕ ਹੈ ਜੀ ਅੱਛਾ ਅਤੇ ਥੋੜ੍ਹੀ ਡਿਜ਼ਾਇਨੀਗ ਡਿਜੁਇਨਿੰਗ ਜੀ ਵਿੱਚ ਹੋ ਜਾਵੇ ਤਾਂ ਜਿਹੜੀ ਜਿਹੜੀ ਪਤਾ ਭਾਅ ਜੀ ਕੀ ਗੱਲ ਹੈ ਘਰ 'ਤੇ ਬੜਾ ਖਰਚਾ ਹੋ ਗਿਆ ਆਪਾਂ ਨੂੰ ਜਿਹੜਾ ਕੰਮ ਸਸਤੇ 'ਚ ਪੈ ਜਾਵੇ ਕੰਮ ਸਸਤੇ 'ਚ ਹੋ ਜਾਵੇ ਅਤੇ ਕੰਮ ਵਧੀਆ ਹੋ ਜਾਵੇ ਬਸ ਮੇਨ ਗੱਲ ਇੱਥੇ ਇਹ ਮੁੱਕਦੀ ਹੈ ਠੀਕ ਹੈ ਨਾ ਬਈ ਚਾਹੇ ਤੁਸੀਂ ਸੀਨਰੀ ਲਗਵਾ ਦਿਓ ਬਈ ਇੱਕ ਇੱਕ ਸੀਨਰੀ ਹੋ ਗਈ ਇੱਕ ਇੱਕ ਇੱਕ ਬੋਲ 'ਤੇ ਸੀਨਰੀ ਹੋ ਗਈ ਅਤੇ ਇੱਕ ਬੋਲ 'ਤੇ ਬਾਕੀ ਇੱਕ ਇੱਕ ਬਾਕੀ ਦੋਨੋਂ ਸਿੰਪਲ ਕਰ ਦਿਓ ਕਿਉਂਕਿ ਹੁਣ ਫਿਰ ਉਹ ਉਹਦੇ ਲਈ ਟਾਈਮ ਵੀ ਉੰਨਾ ਲੱਗੇਗਾ ਮੈਨੂੰ ਟਾਈਮ ਵੀ ਦੱਸ ਦਿਓ ਦੋਨੋਂ ਕਮਰੇ ਕਰਨ 'ਚ ਟਾਈਮ ਕਿੰਨਾ ਲੱਗ ਜਾਵੇਗਾ ਕਿਉਕਿ ਹਜੇ ਕੋਠੀ ਤਾਂ ਨਹੀਂ ਕਰਾਣਾ ਕੰਮ ਸਾਰਾ ਇੱਕ ਬਾਰੀ ਦੋ ਕਮਰੇ ਤਿਆਰ ਕਰਕੇ ਬਹਿਣ ਜੋਗੇ ਹੋ ਜਾਈਏ ਵੀ ਚਲੋ ਕੋਈ ਘਰ ਦਾ ਆਇਆ ਗਿਆ ਹੋਵੇ ਤਾਂ ਬੰਦਾ ਚੱਲ ਬਹਿਣ ਜੋਗਾ ਹੋ ਜਾਂਦਾ ਵੀ ਤੁਸੀਂ ਫਿਰ ਦੋ ਕਮਰਿਆਂ ਦਾ ਮੈਨੂੰ ਸਾਰਾ ਐਸਟੀਮੇਟ ਦੱਸ ਦਿਓ ਮਾੜਾ ਜਿਹਾ ਵੀ ਕੀ ਹੈ ਅਤੇ ਕੀ ਰਹਿਤ ਕਰੋਗੇ ਠੀਕ ਹੈ ਜੀ ਵਾਈਟ ਕਲਰ ਕਰ ਦਿੰਦੇ ਹਾਂ ਵਾਈਟ ਤਾਂ ਨਹੀਂ ਕਰਦੇ ਕਿਉਂਕਿ ਨਾ ਬੱਚੇ ਹੈਗੇ ਆ ਨਹੀਂ ਵਾਈਟ ਤੁਸੀਂ ਕਿਹਾ ਹਾਂ ਆਪਾਂ ਆਪਾਂ ਆਪਾਂ ਪਤਾ ਕੀ ਹਾਂ ਬ ਆਪਾਂ ਡਿਜ਼ਾਇਨਿੰਗ 'ਤੇ ਮੈਂ ਇਹ ਕਹਿ ਰਿਹਾ ਸੀ ਆਪਾਂ ਡਿਜ਼ਾਈਨ 'ਤੇ ਥੋੜ੍ਹਾ ਘੱਟ ਧਿਆਨ ਦੇ ਲਈਏ ਭਾਵੇਂ ਆਪਾਂ ਉਹਦੇ ਕੀ ਕਹਿੰਦੇ ਆ ਉਹਦੀ ਕੁਆਲਿਟੀ ਹੈ ਨਾ ਜਿਹੜੀ ਤੁਸੀਂ ਤੁਹਾਡੀ ਪੇਂਟ ਆਵੇਗਾ ਬਾਲਟੀ ਆਵੇਗੀ ਉਹਦੇ 'ਤੇ ਆਪਾਂ ਥੋੜ੍ਹਾ ਟਾਈਮ ਜ਼ਿਆਦਾ ਦੇ ਦੇਈਏ ਹਾਂ ਫਿਨੀਸਿੰਗ ਉਹ ਜਿਹੜਾ ਕੰਮ ਜਿਹੜਾ ਜਿਹੜਾ ਸਾਲਾ ਉਹ ਦੋ ਦਿਨ ਚਾਰ ਦਿਨਾਂ 'ਚ ਚਾਰ ਸਾਲਾਂ ਦੇ ਵਿੱਚ ਇਹਨੇ ਖਤਰ ਖਰਾਬ ਹੋਣਾ ਉਹ ਸਾਲਾ ਛੇ ਸਮਾਂ 'ਚ ਖਰਾਬ ਹੋਵੇ ਚਲੋ ਚੀਜ਼ ਨੇ ਤਾਂ ਖਰਾਬ ਹੁੰਦੀ ਹੈ ਵੀ ਚਲ ਕੁਆਲਿਟੀ ਵਧੀਆ ਹੋਵੇ ਤਾਂ ਚਲੋ ਟਾਈਮ ਜ਼ਿਆਦਾ ਖਰਾਬ ਨਹੀਂ ਹੁੰਦੀ ਹਾਂ ਤੁਸੀਂ ਰੇਟ ਦੱਸ ਦਿਓ ਫਿਰ ਜੀ ਕਿੰਨਾ ਕੁ ਹੋਏ ਰੇਟ

ਠੀਕ ਹੈ ਜੀ ਚਲੋ ਫਿਰ ਤੁਸੀਂ ਪਰਸੋਂ ਮੇਰੇ ਕੋਲ ਵਿਜਿਟ ਕਰ ਲਿਆ ਜੇ ਇੱਥੇ ਹੀ ਬੀਕਾਨੇਰ ਰੋਡ 'ਤੇ ਹਾਂਜੀ ਹਾਂਜੀ ਠੀਕ ਹੈ ਫਿਰ ਤੁਸੀਂ ਮੈਂ ਤੁਹਾਨੂੰ ਵਟਸਐਪ ਕਰ ਦਾਂਗਾ ਇਹਦੇ 'ਤੇ ਹੀ ਅਤੇ ਆਪਾਂ ਫਿਰ ਰੇਟ ਦਾ ਡਿਸਕਸ਼ਨ ਤੁਸੀਂ ਇੱਥੇ ਆ ਕੇ ਰੇਟ ਦਾ ਡਿਸਕਸ਼ਨ ਕਰ ਲਾਂਗੇ ਆਪਾਂ ਠੀਕ ਹੈ ਜੀ ਤਾਂ ਓਕੇ ਧੰਨਵਾਦ ਜੀ ਬਸ ਜੀ ਬਸ ਬਸ